ਮੈਂ ਅੱਜ ਇੱਕ ਆਨਲਾਈਨ ਸਟੋਰ ਦੇ ਉੱਤੇ ਵਿੰਡੋ ਸ਼ਾਪਿੰਗ ਕਰਕੇ ਆਪਣੇ ਵਾਸਤੇ ਇੱਕ ਅੱਛਾ ਜਿਹਾ ਸਮਾਰਟ ਟੀਵੀ ਲੱਭਣ ਵਾਸਤੇ ਐਮਜ਼ੋਨ ਪ੍ਰਾਈਮ ਦੀ ਵਿੰਡੋ ਸ਼ੋਪਿੰਗ 'ਤੇ ਬਰਾਊਜ ਕੀਤਾ ਅਤੇ ਉੱਥੇ ਜਾ ਕੇ ਮੈਂ ਸਰਚ ਕੀਤਾ ਕਿ ਕਿਹੜੇ ਕਿਹੜੇ ਸਮਾਰਟ ਟੀਵੀ ਉਪਲਬਧ ਹਨ ਅਤੇ ਉਹਨਾਂ ਦੇ ਵਿੱਚੋਂ ਮੈਂ ਇੱਕ ਸਮਾਰਟ ਟੀਵੀ ਨੂੰ ਪਸੰਦ ਕਰਕੇ ਕਾਰਡ ਦੇ ਵਿੱਚ ਸ਼ਾਮਿਲ ਕਰ ਲਿਤਾ